ਮੈਂ ਰਾਮਦਾਸ ਪਿੰਡ ਨਵਾਂ ਗਰਾਂ ਡਾਕਖਾਨਾ ਸੁਜਾਨਪੁਰ ਤਹਿਸੀਲ ਅਤੇ ਜਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਸਥਾਨਕ ਕਲਾਕਾਰ ਆਪਣੀ ਕਲਾ ਨਾਲ ਆਪਣੇ ਸਥਾਨ ਅਤੇ ਰਾਜ ਦੀ ਕਲਾ ਅਤੇ ਸੱਭਿਆਚਾਰ ਨੂੰ ਸਮੁੱਚੇ ਤੌਰ 'ਤੇ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪੰਜਾਬੀ ਦੇ ਕਲਾਕਾਰ ਪੰਜਾਬ ਦੇ ਕਲਾਕਾਰ ਜਾਂ ਪੰਜਾਬੀ ਨਾਲ ਸੰਬੰਧਿਤ ਕਲਾਕਾਰ ਉਹਨਾਂ ਨੇ ਪੰਜਾਬ ਰਾਜ ਦੀ ਕਲਾ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਹੈ ਪੰਜਾਬ ਦੇ ਕਲਾਕਾਰਾਂ ਵਿੱਚ ਖ਼ਾਸ ਕਰਕੇ ਗਾਇਕਾਂ ਦੇ ਵਿੱਚ ਜਿਵੇਂ ਕਿ ਲਾਲ ਚੰਦ ਯਮਲਾ ਜੱਟ ਹੰਸਰਾਜ ਹੰਸ ਜਸਵੀਰ ਜੱਸੀ ਕੁਲਦੀਪ ਮਾਣਕ ਆਦਿ ਆਦਿ ਕਲਾਕਾਰਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਕਲਾ ਨੂੰ ਆਪਣੇ ਗੀਤਾਂ ਦੇ ਵਿੱਚ ਪਰੋ ਕੇ ਅਤੇ ਇਹਨੂੰ ਸੁਰੱਖਿਅਤ ਰੱਖਣ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਹੈ